ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਤਰਨ ਤਾਰਨ ਦਾ ਟਰਾਂਸਪੋਟੇਸ਼ਨ ਸਿਸਟਮ ਬਹੁਤ ਵਧੀਆ ਬਹੁਤ ਜ਼ਿਆਦਾ ਡਿਵੈਲਪ ਹੋ ਚੁੱਕਾ ਹੁਣ ਤਾਂ ਕਾਫੀ ਜ਼ਿਆਦਾ ਆਪਸ਼ਨਸ ਆਪਣੇ ਕੋਲ ਹੈਗੀਆਂ ਬੱਸਿਸ ਤੋਂ ਲੈ ਕੇ ਕੈਬਸ ਤੱਕ ਐਵਰੀਥਿੰਗ ਅਵੇਲੇਬਲ ਲੋਕਲ ਟਰੈਵਲ ਕਰਨ ਵਾਸਤੇ ਤੁਸੀਂ ਈ ਰਿਕਸ਼ਾ ਦਾ ਵੀ ਯੂਜ ਕਰ ਸਕਦੇ ਹੋ ਟੈਂਨ ਰੁਪੀਸ ਮੈਕਸੀਮਮ ਲੱਗਦੇ ਆ ਔਰ ਤੁਸੀਂ ਓਟੋਜ਼ ਵੀ ਲੈ ਸਕਦੇ ਹੋ ਮਤਲਬ ਕਾਫੀ ਜ਼ਿਆਦਾ ਆਪਸ਼ਨਸ ਹੈਗੀਆਂ ਆ ਸਿਟੀ ਤੋਂ ਸਿਟੀ ਤੁਸੀਂ ਬਾਏ ਹਾਂਜੀ ਅੰਮ੍ਰਿਤਸਰ ਜਾਣ ਲਈ ਤੁਸੀਂ ਬਾਏ ਟ੍ਰੇਨ ਵੀ ਜਾ ਸਕਦੇ ਹੋ ਫਿਰ ਤੁਹਾਡੇ ਕੋਲੇ ਬੱਸਿਸ ਦੀ ਵੀ ਔਪਸ਼ਨ ਆ ਔਰ ਕੈਬਸ ਤਾਂ ਫਿਰ ਹੈ ਹੀ ਬੁੱਕ ਕਰਨ ਵਾਸਤੇ ਐਪਲੀਕੇਸ਼ਨਸ ਤੁਸੀਂ ਊਬਰ ਕੈਬ ਏਜੰਸਿਜ਼ ਕਰ ਸਕਦੇ ਹੋ ਡਾਊਨਲੋਡ ਜਾਂ ਫਿਰ ਤੁਸੀਂ ਓਲਾ ਕੈਬ ਇਜੰਸਿਜ਼ ਕਰ ਸਕਦੇ ਹੋ ਮੇਕ ਮਾਈ ਟਰਿਪਸ ਵਗੈਰਾ ਇਹ ਸਾਰੀਆਂ ਤੁਹਾਡੇ ਕੋਲੇ ਔਪਸ਼ਨ ਹੈਗੀਆਂ ਆ ਹਾਂਜੀ ਹਾਂਜੀ